ਸਤਿ ਸ਼੍ਰੀ ਅਕਾਲ ਜੀ ਹੋਰ ਸਰ ਕੀ ਹਾਲ ਚਾਲ ਆ ਬਸ ਵਧੀਆ ਜੀ ਵਧੀਆ ਮੈਂ ਨਾ ਕਈ ਦਿਨ ਤੋਂ ਸੋਚ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰੀਏ ਅਤੇ ਹੁਣ ਤੁਹਾਨੂੰ ਲੱਗਦਾ ਵੀ ਬੱਚੇ ਜ਼ਿਆਦਾ ਹੈ ਨਾ ਕਿਸ ਫੀਲਡ ਵੱਲ ਜਾ ਰਹੇ ਨੇ ਹਮ ਹਮ ਅੱਛਾ ਹਾਂ ਇਹ ਤਾਂ ਹਾਂਜੀ ਹਾਂਜੀ

ਨਹੀਂ ਬਸ ਇਹੀ ਲੱਗਦਾ ਦੋਵੇਂ ਹਾਂ ਸਗੋਂ ਬਹੁਤ ਵਧੀਆ ਜੀ ਚਲੋ ਇਸ ਬਾਰੇ ਨਾ ਮੈਨੂੰ ਫਿਰ ਥੋੜ੍ਹਾ ਜਿਵੇਂ ਤੁਸੀਂ ਹੋਰ ਪੜ੍ਹਿਆ ਤੁਸੀਂ ਹੋਰ ਹੋਰ ਰਿਸਰਚ ਵੱਲ ਵਧੇ ਅਤੇ ਥੋੜ੍ਹਾ ਮੇਰੇ ਕੋਂਟੈਕਟ 'ਚ ਰਹਿਣਾ ਅਤੇ ਥੋੜ੍ਹਾ ਦੱਸਿਓ ਹਾਂ